ਮੈਂ ਔਨਲਾਈਨ ਸ਼ੋਪਿੰਗ ਕਾਰਡ ਵਿੱਚ ਕੁਛ ਆਈਟਮਾਂ ਨੂੰ ਸ਼ਾਮਿਲ ਕੀਤਾ ਸੀ ਜਿਵੇਂ ਲਾਈਕ ਮੈਨੂੰ ਜੁੱਤੀ ਪਸੰਦ ਆਈ ਸੀ ਉਹਨੂੰ ਮੈਂ ਵਿਸ਼ਲਿਸਟ ਵਿੱਚ ਐਡ ਕੀਤਾ ਉਸ ਤੋਂ ਬਾਅਦ ਮੈਨੂੰ ਸੂਟ ਪਸੰਦ ਆਇਆ ਉਸਨੂੰ ਮੈਂ ਵਿਸ਼ਲਿਸਟ ਵਿੱਚ ਐਡ ਕੀਤਾ ਔਰ ਮੈਨੂੰ ਬੈਗ ਪਸੰਦ ਆਇਆ ਉਹਨੂੰ ਵਿਸ਼ਲਿਸਟ ਵਿੱਚ ਮੈਂ ਐਡ ਕੀਤਾ ਕਿਉਂਕਿ ਮਤਲਬ ਮੈਨੂੰ ਹਾਲੇ ਮਤਲਬ ਮੈਂ ਇਹ ਚੀਜ਼ ਸੋਚ ਰਹੀ ਸੀ ਕਿ ਮੈਂ ਖਰੀਦਾਂ ਜਾਂ ਨਾ ਖਰੀਦਾਂ ਇਸ ਕਰਕੇ ਮੈਂ ਉਹਨਾਂ ਨੂੰ ਮੈਂ ਵਿਸ਼ਲਿਸਟ ਵਿੱਚ ਐਡ ਕੀਤਾ ਉਸ ਤੋਂ ਬਾਅਦ ਜਦੋਂ ਮੈਨੂੰ ਮਤਲਬ ਮੈਂ ਉਹਨਾਂ ਦੀ ਕੁਆਂ ਜੋ ਵੀ ਚੀਜ਼ ਦੇਖੀ ਮਤਲਬ ਕਿ ਕਿਨੀ ਕਦੋਂ ਤੱਕ ਡਿਲੀਵਰਡ ਹੋ ਸਕਦੀ ਜਾਂ ਉਹਦਾ ਰੇਟ ਦੇਖਿਆ ਉਹਦਾ ਕਲਰ ਦੇਖਿਆ ਕਿ ਮੇਰੇ ਅਕੋਰਡਿੰਗ ਕੋਈ ਹੋਰ ਕਲਰ ਮੈਨੂੰ ਮਿਲ ਸਕਦਾ ਹੈ ਜਾਂ ਨਹੀਂ ਤਾਂ ਮੈਂ ਦੇਖਿਆ ਕਿ ਮਤਲਬ ਮੇਰੇ ਅਕੋਰਡਿੰਗ ਕੁਛ ਵੀ ਨਹੀਂ ਸੀ ਇਸ ਕਰਕੇ ਮੈਂ ਉਹਨਾਂ ਨੂੰ ਉਸ ਵਿਸ਼ਲਿਸਟ ਵਿੱਚੋਂ ਰਿਮੂਵ ਕਰਤਾ ਅਦਰਵਾਈਜ ਉਹ ਮੈਨੂੰ ਮੈਸੇਜ ਉਸ ਉਸ ਮਤਲਬ ਚੀਜ਼ ਨਾਲ ਰਿਲੇਟਡ ਮੈਨੂੰ ਬਾਰ ਬਾਰ ਰਿਮਾਇੰਡਰ ਜਾਂ ਜਿਵੇਂ ਮੈਸੇਜ ਆਉਂਦੇ ਸੀ ਕਿ ਮਤਲਬ ਇਸਦਾ ਇਸ ਤਰ੍ਹਾਂ ਦੇ ਪ੍ਰੋਡਕਟ ਹੋਰ ਵੀ ਹੈ ਇਸ ਕਰਕੇ ਮੈਨੂੰ ਉਹਨਾਂ ਨੂੰ ਵਿਸ਼ਲਿਸਟ ਵਿੱਚੋਂ ਰਿਮੂਵ ਕਰਨਾ ਪੜਾ